ਪੰਜਾਬ ਦੇ ਇਤਿਹਾਸ ਨੂੰ ਬਹੁਤ ਸਾਰੇ ਪ੍ਰਮੁੱਖ ਸੱਭਿਆਚਾਰਕ ਪ੍ਰਭਾਵਾਂ ਨੇ ਆਕਾਰ ਦਿੱਤਾ ਹੈ ਇਹਨਾਂ ਵਿੱਚ ਧਰਮ ਭਾਸ਼ਾ ਕਲਾ ਅਤੇ ਆਰਕੀਟੈਕਚਰ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਆਓ ਹਰ ਇੱਕ ਨੂੰ ਆਪਾਂ ਮੁੱਖ ਰੱਖਦੇ ਨਜ਼ਰ ਮਾਰੀਏ ਜਿਵੇਂ ਕਿ ਪਹਿਲਾਂ ਸਿੱਖ ਧਰਮ ਸਿੱਖ ਧਰਮ ਦਾ ਜਨਮ ਪੰਦਰ੍ਹਵੀਂ ਸਦੀ ਵਿੱਚ ਪੰਜਾਬ ਦੇ ਵਿੱਚ ਹੋਇਆ ਗੁਰੂ ਨਾਨਕ ਦੇਵ ਜੀ ਇਸ ਧਰਮ ਦੇ ਸਪਾਤ ਸੰਸਥਾਪਕ ਸਨ ਸਿੱਖ ਧਰਮ ਦੀਆਂ ਸਿੱਖਿਆਵਾਂ ਅਤੇ ਗੁਰਬਾਣੀ ਨੇ ਪੰਜਾਬੀ ਲੋਕਾਂ ਦੇ ਜੀਵਨ ਸੱਭਿਆਚਾਰਕ ਅਤੇ ਰੀਤੀ ਰਿਵਾਜ਼ਾਂ 'ਤੇ ਗਹਿਰਾ ਪ੍ਰਭਾਵ ਪਾਇਆ ਹੈ ਸ਼੍ਰੀ ਹਰਿਮੰਦਰ ਸਾਹਿਬ ਸਿੱਖਾਂ ਦੇ ਸਭ ਤੋਂ ਪ੍ਰਮੁੱਖ ਅਤੇ ਪਵਿੱਤਰ ਸ਼ਹਿਰ ਵਜੋਂ ਹੈ ਇਹਨਾਂ ਦੇ ਵਿੱਚ ਗੋਲਡਨ ਟੈਂਪਲ ਸਿੱਖਾਂ ਦੇ ਇੱਕ ਧਾਰਮਿਕ ਪਵਿੱਤਰ ਸਥਾਨ ਹੈ ਦੂਸਰਾ ਸੰਯੁਕਤ ਧਰਮ ਇਸ ਖੇਤਰ ਨੇ ਬੁੱਧ ਧਰਮ ਜੈਨ ਧਰਮ ਹਿੰਦੂ ਧਰਮ ਅਤੇ ਇਸਲਾਮਿਕ ਜਿਹੇ ਧਰਮਾਂ ਨੂੰ ਗ੍ਰਹਿਣ ਕੀਤਾ ਹੋਇਆ ਹੈ ਇਹਨਾਂ ਧਰਮਾਂ ਅਤੇ ਰਵਾਇਤਾਂ ਦੇ ਤਿਉਹਾਰ ਅਤੇ ਰੀਤੀ ਰਿਵਾਜ਼ਾਂ ਨੂੰ ਪੰਜਾਬੀ ਲੋਕ ਆਦਰ ਅਤੇ ਮਾਣ ਦਿੰਦੇ ਹਨ ਦੂਜਾ ਪੰਜਾਬੀ ਭਾਸ਼ਾ ਪੰਜਾਬ ਦੀ ਮੁੱਖ ਭਾਸ਼ਾ ਹੈ ਅਤੇ ਇਸ ਦਾ ਵਿਕਾਸ ਸਦੀਆਂ ਤੋਂ ਹੁੰਦਾ ਆ ਰਿਹਾ ਹੈ ਪੰਜਾਬੀ ਸਿਹਤ ਸ਼ਾਇਰੀ ਅਤੇ ਗੀਤਾਂ ਦੇ ਲੋਕਾਂ ਦੇ ਜੀਵਨ ਅਤੇ ਸੱਭਿਆਚਾਰਕ ਵਿਰਾਸਤ 'ਤੇ ਗਹਿਰਾ ਪ੍ਰਭਾਵ ਪਾਇਆ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਿੱਖ ਧਰਮ ਦਾ ਪਵਿੱਤਰ ਗ੍ਰੰਥ ਹੈ ਵੀ ਪੰਜਾਬੀ ਭਾਸ਼ਾ ਵਿੱਚ ਲਿਖਿਆ ਗਿਆ ਹੈ ਇਸ ਤੋਂ ਇਲਾਵਾ ਪੰਜਾਬੀ ਭਾਸ਼ਾ ਦਾ ਇੱਕ ਪ੍ਰਮੁੱਖ ਚਿਹਰਾ ਸਿੱਧੂ ਮੂਸੇਆਲਾ ਜੋ ਕਿ ਇੱਕ ਇੰਟਰਨੈਸ਼ਨਲ ਲੈਵਲ ਦਾ ਸਿੰਗਰ ਵੀ ਬਣਿਆ ਹੋਇਆ ਹੈ ਉਰਦੂ ਅਤੇ ਫਾਰਸ ਫਾਰਸੀ ਇਸਲਾਮ ਦੇ ਅਰਬੀ ਅਤੇ ਫਾਰਸੀ ਪ੍ਰਭਾਵਾਂ ਦੇ ਕਾਰਨ ਉਰਦੂ ਭਾਸ਼ਾ ਦਾ ਵੀ ਪੰਜਾਬ ਵਿੱਚ ਕੁਝ ਪ੍ਰਭਾਵ ਹੈ ਖਾਸ ਕਰਕੇ ਮੱਧਕਾਲੀ ਕਵਿਤਾ ਅਤੇ ਸਿਹਤ ਵਿੱਚ ਮਾਲਵਾ ਖੇਤਰ ਦੇ ਵਿੱਚ ਮਲਵਈ ਭਾਸ਼ਾ ਦੁਆਬਾ ਖੇਤਰ ਦੇ ਵਿੱਚ ਦੁਆਬੀ ਭਾਸ਼ਾ ਮਾਝਾ ਖੇਤਰ ਦੇ ਵਿੱਚ ਮਾਝੇ ਦੇ ਨਾਲ ਨਾਲ ਉਰਦੂ ਦਾ ਵੀ ਸੰਮੇਲਨ ਦੇਖਣ ਨੂੰ ਮਿਲਦਾ ਹੈ ਇਸ ਤੋਂ ਇਲਾਵਾ ਪੰਜਾਬ ਦੇ ਤਿੰਨ ਪਾਸਿਆਂ ਤੋਂ ਇਲਾਵਾ ਵਰਗਾਂ ਤੋਂ ਇਲਾਵਾ ਚੌਥੀ ਪੁਆਧੀ ਨੂੰ ਵੀ ਮਾਨਤਾ ਦਿੱਤੀ ਗਈ ਹੈ ਪੁਆਧੀ ਜਿਹੜੀ ਕਿ ਚੰਡੀਗੜ੍ਹ ਰੋਪੜ ਅਨੰਦਪੁਰ ਸਾਹਿਬ ਅਤੇ ਹਿਮਾਚਲ ਦੇ ਮਿਕਸ ਏਰੀਏ ਨੂੰ ਪਰਜੈਂਟ ਕਰਦੀ ਹੈ ਭੰਗੜਾ ਅਤੇ ਗਿੱਧਾ ਪੰਜਾਬ ਦੇ ਲੋਕ ਨ੍ਰਿੱਤ ਭੰਗੜਾ ਅਤੇ ਗਿੱਧਾ ਦੁਨੀਆ ਭਰ ਦੇ ਵਿੱਚ ਜਿਵੇਂ ਕਿ ਮਸ਼ਹੂਰ ਹੈ ਉੱਥੇ ਨ੍ਰਿੱਤ ਰੂਪ ਖੁਸ਼ੀ ਅਤੇ ਜੋਸ਼ ਦਾ ਪ੍ਰਤੀਕ ਹੈ ਅਤੇ ਅਕਸਰ ਵੱਖ ਵੱਖ ਮੌਕਿਆਂ ਉੱਤੇ ਭੰਗੜਾ ਕੀਤਾ ਜਾਂਦਾ ਹੈ ਜਿਵੇਂ ਕਿ ਵਿਆਹਾਂ ਦੇ ਵਿੱਚ ਅਕਤੂਬਰ ਮੰਥ ਦੇ ਵਿਆਹਾਂ ਦੇ ਵਿੱਚ ਇਸ ਨੂੰ ਖਾਸ ਤੌਰ ਦੇ ਉੱਤੇ ਜ਼ੋਰ ਦਿੱਤਾ ਜਾਂਦਾ ਹੈ ਭੰਗੜੇ 'ਤੇ ਡਿਮਾਂਡ ਕੀਤੀ ਜਾਂਦੀ ਹੈ ਕਿ ਸਟੇਜ ਦੇ ਉੱਤੇ ਵੀ ਲਾੜਾ ਭੰਗੜਾ ਪਾਵੇ ਬੋਲੀਆਂ ਪਾਵੇ ਪੰਜਾਬੀ ਸੰਗੀਤ ਪੰਜਾਬੀ ਸੰਗੀਤ ਗੁਰਬਾਣੀ ਅਤੇ ਸੂਫੀ ਸੰਗੀਤ ਦੇ ਰੂਪ ਨਾਲ ਵੱਖ ਵੱਖ ਰਾਗ ਸੰਗੀਤਕਾਰ ਢੰਗ ਹਨ ਸੂਫੀ ਸੰਤ ਕਵਿਤਾ ਅਤੇ ਗਜ਼ਲਾਂ ਵੀ ਪੰਜਾਬੀ ਕਲਾ 'ਤੇ ਪਾਬੰਦੀ ਹੈ ਧੰਨਵਾਦ